ਹਾਂ ਅੱਜ ਦੇ ਸਮੇਂ ਦੇ ਵਿੱਚ ਮਾਨਸਿਕ ਸਿਹਤ ਦੀ ਸਮੱਸਿਆ ਬਹੁਤ ਵੱਧਦੀ ਜਾ ਰਹੀ ਹੈ ਲੋਕਾਂ ਵਿੱਚ ਸਟਰੈੱਸ ਦਾ ਲੈਵਲ ਇੰਨਾ ਵੱਧ ਗਿਆ ਹੈ ਕਿ ਉਹ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਹੈ ਕਿ ਉਹ ਦਿਨੋ ਬਰ ਦਿਨ ਹੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਅੱਜ ਦੇ ਇਸ ਸਮੇਂ ਦੇ ਵਿੱਚ ਖਾਸ ਕਰ ਸਟੂਡੈਂਟਾਂ ਮਨ ਚਾਹਿਆ ਰਿਜ਼ਲਟ ਨਾ ਪਾਉਣ ਕਾਰਨ ਡਿਪਰੈਸ਼ਨ ਅਤੇ ਇਕੱਲੇਪਨ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਸ ਤੋਂ ਇਲਾਵਾ ਇਸ ਇਹ ਸਮੱਸਿਆਵਾਂ ਲੇਡੀਜ਼ ਵਿੱਚ ਸਭ ਤੋਂ ਵੱਧ ਦੇਖੀ ਜਾ ਰਹੀ ਹੈ ਕਿਉਂਕਿ ਉਹ ਸਾਰਾ ਦਿਨ ਘਰ ਰਹਿੰਦੀਆਂ ਹਨ ਅਤੇ ਇਕੱਲੇਪਨ ਹੋਣ ਕਰਕੇ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀਆਂ ਹਨ ਸਰਕਾਰ ਦੁਆਰਾ ਇਹਨਾਂ ਇਹਨਾਂ ਜੀ ਸਮੱਸਿਆਵਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਥਾਂ ਥਾਂ 'ਤੇ ਕੈਂਪ ਲਾਏ ਜਾ ਰਹੇ ਹਨ ਗੁਰਦੁਆਰਾ ਸਾਹਿਬ ਮੰਦਰ ਹਰ ਜਗ੍ਹਾ 'ਤੇ ਕੈਂਪ ਲਾਏ ਜਾ ਰਹੇ ਹਨ ਕਿ ਤਾਂ ਕਿ ਲੋਕ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਤੋਂ ਜਾਣੂ ਹੋ ਸਕਣ ਤਾਂ ਕਿ ਇਸ ਤੋਂ ਬਚ ਸਕਣ ਅਤੇ ਇਸ ਦੇ ਨਵੇਂ ਹੱਲ ਕੱਢ ਸਕਣ ਤਾਂ ਕਿ ਉਹਨਾਂ ਦੇ ਮਾਨਸਿਕ ਸੰਤੁਲਨ ਠੀਕ ਰਵੇ ਇਸ ਤੋਂ ਇਲਾਵਾ ਡਿਸਪੈਂਸਰੀਆਂ ਵਿੱਚ ਵੀ ਸਰਕਾਰ ਦੁਆਰਾ ਬਹੁਤ ਸਾਰੀਆਂ ਤਕਨੀਕਾਂ ਨਾਲ ਲੋਕਾਂ ਨੂੰ ਜਾਗਰੂਤ ਕਰਿਆ ਜਾ ਰਿਹਾ ਹੈ ਜਿਵੇਂ ਕਿ ਨੁੱਕੜ ਨਾਟਕ ਹੁੰਦੇ ਹਨ ਅਤੇ ਲੋਕ ਉਸਨੂੰ ਦੇਖਦੇ ਹਨ ਅਤੇ ਉਸ ਦੁਆਰਾ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਚੀਜ਼ਾਂ ਹਨ ਜਿਸ ਨਾਲ ਅਸੀਂ ਆਪਣਾ ਸਾਰੇ ਇੱਕ ਸਵੱਸਥ ਜੀਵਨ ਜੀਅ ਸਕਦੇ ਹਨ